ਹਾਂਜੀ ਗਾਇਣ ਦੇ ਵਿੱਚ ਸਾਹ ਨਿਯੰਤਰਣ ਜਿਹੜਾ ਹੈਗਾ ਇਹ ਇੱਕ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਅਗਰ ਤੁਹਾਡਾ ਜਿਹੜਾ ਹੈਗਾ ਸਾਹ 'ਤੇ ਨਿਯੰਤਰਣ ਨਹੀਂ ਹੋਏਗਾ ਤਾਂ ਤੁਸੀਂ ਅੱਛਾ ਸਉ ਸੁਰ ਨਹੀਂ ਲਗਾ ਸਕਦੇ ਹੋ ਇਸ ਦੇ ਬਾਰੇ ਵਿੱਚ ਵੈਸੇ ਤਾਂ ਮੈਨੂੰ ਕੋਈ ਮਤਲਬ ਤਕਨੀਕੀ ਜਾਣਕਾਰੀ ਹੈ ਨਹੀਂ ਹੈ ਕਿਉਂਕਿ ਮੇਰਾ ਜਿਹੜਾ ਹੈਗਾ ਇਸ 'ਤੇ ਆਪਣੇ ਆਪ ਹੀ ਰੱਬ ਦੇ ਵੱਲੋਂ ਇੱਕ ਮੈਨੂੰ ਕੁਦਰਤ ਦੇ ਵੱਲੋਂ ਹੀ ਇੱਕ ਮਤਲਬ ਮਿਹਰ ਹੋਈ ਮੇਰੇ 'ਤੇ ਕਿ ਮੈਨੂੰ ਇਸ ਚੀਜ਼ ਦੀ ਅਤੇ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਮੇਰਾ ਆਪਣੇ ਆਪ ਹੀ ਸਾਹ 'ਤੇ ਕੰ ਨਿਯੰਤਰਨ ਸੀ ਲੇਕਿਨ ਜਿਹੜੇ ਮਤਲਬ ਸੀਗਿੰਗ ਦੇ ਵਿੱਚ ਸ਼ੌਕ ਰੱਖਦੇ ਹੈ ਗਾਇਕੀ ਦੇ ਵਿੱਚ ਉਹਨਾਂ ਨੂੰ ਜਿਵੇਂ ਉਹ ਮਿਹਨਤ ਕਰਦੇ ਹੈ ਤਾਂ ਉਸ ਚੀਜ਼ ਦੇ ਵਿੱਚ ਆਉਣਾ ਚਾਹੁੰਦੇ ਹੈ ਇਸ ਖੇਤਰ ਦੇ ਵਿੱਚ ਤਾਂ ਉਨ੍ਹਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਸਾਹ 'ਤੇ ਨਿਯੰਤਰਨ ਕਿਵੇਂ ਕੀਤਾ ਜਾਵੇ ਇਸ ਦੇ ਲਈ ਉਹਨਾਂ ਨੂੰ ਜਿਹੜੇ ਕਿ ਇਸਦੇ ਮਤਲਬ ਸਾਹ ਦੇ ਨਿਯੰਤਰਨ 'ਤੇ ਕੁਛ ਯੋਗਾ ਹੈਗੇ ਹਨ ਉਹਨਾਂ ਦਾ ਅਭਿਆਸ ਕਰਨਾ ਚਾਹੀਦਾ ਉਨ੍ਹਾਂ ਨੂੰ ਅਤੇ ਬਾਕੀ ਦੂਜਾ ਉਹਨਾਂ ਨੂੰ ਆਪਣੇ ਮਤਲਬ ਖਾਣ ਪੀਣ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਨੂੰ ਐਸੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜਿਹੜੀਆਂ ਕਿ ਉਨ੍ਹਾਂ ਦੀ ਇਸ ਚੀਜ਼ ਦੇ ਵਿੱਚ ਰੁਕਾਵਟ ਪੈਦਾ ਕਰੇੇ ਅਤੇ ਉਹਨਾਂ ਦੀ ਮਤਲਬ ਅਵਾਜ਼ ਵੀ ਖਰਾਬ ਕਰੇ ਤਾਂ ਉਸਦੇ ਨਾਲ ਉਹਨਾਂ ਦਾ ਆਟੋਮੈਟੀਕਲੀ ਸਾਹ 'ਤੇ ਵੀ ਉਹਨਾਂ ਦੇ ਅਸਰ ਪਏਗਾ